ਹਾਂਜੀ ਆਪਾਂ ਜਿਵੇਂ ਜਾਣਦੇ ਹਾਂ ਕਿ ਆਪਾਂ ਸਾਰੇ ਭਾਰਤ ਦੇ ਵਸਨੀਕ ਹਾਂ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਉੱਤਰੀ ਭਾਰਤ ਅਤੇ ਦੱਖਣੀ ਭਾਰਤ ਵਿੱਚ ਸੱਭਿਆਚਾਰਕ ਅੰਤਰ ਕੀ ਹੈ ਭਾਸ਼ਾ ਭੋਜਨ ਕੱਪੜੇ ਭੂਗੋਲ ਆਦਿ ਨੂੰ ਲੈ ਕੇ ਇਕੱਲੇ ਉੱਤਰੀ ਅਤੇ ਦੱਖਣੀ ਭਾਰਤ ਹੀ ਨਹੀਂ ਆਪਾਂ ਜੇਕਰ ਪੂਰੇ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਆਪਣੇ ਹਰੇਕ ਰਾਜ ਦਾ ਆਪਣਾ ਸੱਭਿਆਚਾਰ ਆ ਆਪਣੀ ਭਾਸ਼ਾ ਗੀ ਆਪਣੀ ਰਾਜਨੀਤੀ ਹੈ ਉਹਨਾਂ ਦੀ ਠੀਕ ਹੈ ਜੀ ਅਲੱਗ ਅਲੱਗ ਤਰ੍ਹਾਂ ਦੇ ਮੌਸਮ ਨੇ ਜੇਕਰ ਆਪਾਂ ਉੱਤਰੀ ਭਾਰਤ ਦੇ ਵਿੱਚ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦਾ ਜੋ ਮੁੱਖ ਭੋਜਨ ਆ ਸਿਆ ਸਰਦੀਆਂ ਦਾ ਭੋਜਨ ਦੀ ਗੱਲ ਕਰ ਲਈਏ ਆਪਾਂ ਮੱਕੀ ਦੀ ਰੋਟੀ ਸਰ੍ਹੋਂ ਦਾ ਸਾਗ ਲੱਸੀ ਦਹੀਂ ਮੱਖਣ ਆਦਿ ਆ ਠੀਕ ਹੈ ਜੀ ਅਤੇ ਉਸੀ ਤਰ੍ਹਾਂ ਜੇਕਰ ਦੱਖਣੀ ਭਾਰਤ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਉਹਨਾਂ ਦਾ ਜ਼ਿਆਦਾਤਰ ਸਾਂਬਰ ਇਡਲੀ ਡੋਸਾ ਇਹ ਚੀਜ਼ਾਂ ਜ਼ਿਆਦਾ ਖਾਂਦੇ ਨੇ ਅਤੇ ਉਹਨਾਂ ਦੇ ਭੋਜਨ ਦੇ ਵਿੱਚ ਥੋੜ੍ਹੀ ਬਹੁਤ ਮਾਸ ਮੱਛੀ ਵੀ ਸ਼ਾਮਿਲ ਆ ਐਂਡ ਅਤੇ ਉਹ ਚੌਲ੍ਹਾਂ ਦੀ ਵਰਤੋਂ ਵੀ ਜ਼ਿਆਦਾ ਕਰਦੇ ਨੇ ਜਿੱਦਾਂ ਇਡਲੀ ਬਣਾਉਂਦੇ ਨੇ ਅਤੇ ਜੇਕਰ ਆਪਾਂ ਭੂਗੋਲਿਕ ਸਥਿਤੀਆਂ ਦੀ ਗੱਲ ਕਰੀਏ ਤਾਂ ਪੰਜਾਬ ਦਾ ਜੋ ਇਲਾਕਾ ਜ਼ਿਆਦਾਤਰ ਮੈਦਾਨੀ ਆ ਸਮੁੰਦਰੀ ਤਲ ਤੋਂ ਦੂਰ ਆ ਅਤੇ ਜੇਕਰ ਆਪਾਂ ਦੱਖਣੀ ਭਾਰਤ ਦੀ ਗੱਲ ਕਰੀਏ ਤਾਂ ਕੁਛ ਕੁ ਇਲਾਕੇ ਉਹਨਾਂ ਦੇ ਜੋ ਸਮੁੰਦਰ ਦੇ ਨੇੜੇ ਨੇ ਉੱਥੇ ਮੀਂਹ ਵੀ ਜ਼ਿਆਦਾ ਪੈਂਦਾ ਉਨ੍ਹਾਂ ਇਲਾਕਿਆਂ ਦੇ ਵਿੱਚ ਅਤੇ ਨਾਲ ਨਾਲ ਉੱਥੇ ਗਰਮੀ ਵੀ ਥੋੜ੍ਹੀ ਜ਼ਿਆਦਾ ਕਿਉਂਕਿ ਸਮੁੰਦਰ ਦੇ ਬਿਲਕੁਲ ਕਿਨਾਰੇ 'ਤੇ ਆ ਗਏ ਨੇ ਉਹ ਹੋਰ ਭਾਸ਼ਾ ਦੀ ਗੱਲ ਕਰੀਏ ਭਾਸ਼ਾ ਤਾਂ ਇੱਕ ਸ ਰਾਜ ਦੇ ਵਿੱਚ ਹੀ ਥੋੜ੍ਹੀ ਥੋੜ੍ਹੀ ਦੂਰੀ 'ਤੇ ਭਾਸ਼ਾ ਬਦਲਦੀ ਰਹਿੰਦੀ ਆ ਇਹ ਤਾਂ ਫੇਰ ਵੀ ਆਪਾਂ ਉੱਤਰੀ ਅਤੇ ਦੱਖਣੀ ਭਾਰਤ ਦੀ ਗੱਲ ਕਰ ਰਹੇ ਹਾਂ ਜਿਵੇਂ ਉੱਧਰਲੀਆਂ ਉੱਤਰੀ ਭਾਰਤ ਦੀਆਂ ਭਾਸ਼ਾਵਾਂ ਦੀ ਗੱਲ ਕਰੀਏ ਮਲਿਆਲਮ ਕੰਨੜ ਤਾਮਿਲ ਤੇਲਗੂ ਇੱਧਰ ਆਪਾਂ ਗੱਲ ਕਰੀਏ ਤਾਂ ਆਪਣੀਆਂ ਸਥਾਨਕ ਭਾਸ਼ਾਵਾਂ ਜਿਵੇਂ ਪੰਜਾਬ ਦੇ ਵਿੱਚ ਪੰਜਾਬੀ ਬੋਲੀ ਜਾਂਦੀ ਹੈ ਹਿਮਾਚਲ ਦੇ ਵਿੱਚ ਕੁਛ ਏਰੀਏ ਦੇ ਵਿੱਚ ਡੋਗਰੀ ਬੋਲੀ ਜਾਂਦੀ ਹੈ ਜੰਮੂ ਕਸ਼ਮੀਰ ਦੀ ਗੱਲ ਕਰ ਲਈਏ ਉੱਧਰ ਡੋਗਰੀ ਵੀ ਬੋਲੀ ਜਾਂਦੀ ਹੈ ਕੁਛ ਏਰੀਏ ਦੇ ਵਿੱਚ ਇਸੇ ਤਰ੍ਹਾਂ ਬਹੁਤ ਜ਼ਿਆਦਾ ਫਰਕ ਆ ਭਾਸ਼ਾ ਭੋਜਨ ਅਤੇ ਕੱਪੜੇ ਦਾ ਹਰੇਕ ਰਾਜ ਦੇ ਵਿੱਚ ਥੋੜ੍ਹੇ ਥੋੜ੍ਹੀ ਦੂਰੀ ਅਤੇ ਇਹਨਾਂ ਦਾ ਫਰਕ ਪੈਂਦਾ ਰਹਿੰਦਾ